ਸਾਡੇ ਇੱਥੇ ਆਵਾਜਾਈ ਦੀ ਘਾਟ ਨੇੜਲੇ ਸ਼ਹਿਰਾਂ ਵਿੱਚ ਬਹੁਤ ਹੀ ਘੱਟ ਹੈ ਜਿਵੇਂ ਕਿ ਸਾਡੇ ਪਿੰਡ ਸਾਡਾ ਕਿ ਇੱਥੇ ਪਿੰਡ ਹੈ ਇਸੇ ਕਰਕੇ ਮੈਨੂੰ ਪਿੰਡ ਤੋਂ ਸ਼ਹਿਰ ਜਾਣਾ ਪੈਂਦਾ ਹੈ ਇੱਥੇ ਵੱਖ ਵੱਖ ਜਿਵੇਂ ਕਿ ਆਉਂਦੀਆਂ ਰਹਿੰਦੀਆਂ ਹਨ ਬੱਸਾਂ ਕਈ ਬੱਸਾਂ ਸਾਡੇ ਇੱਥੇ ਬਹੁਤ ਹੀ ਭਰ ਕੇ ਆਉਂਦੀਆਂ ਰਹਿੰਦੀਆਂ ਹਨ ਜਿਸ ਕਰਕੇ ਸਾਨੂੰ ਉਸ ਵਿੱਚ ਜਗ੍ਹਾ ਨਹੀਂ ਮਿਲਦੀ ਇਸ ਕਰਕੇ ਸਾਨੂੰ ਦੂਸਰੀ ਬੱਸ ਦੀ ਉਡੀਕ ਕਰਨੀ ਪੈਂਦੀ ਹੈ ਅਤੇ ਜੋ ਕਿ ਸਾਨੂੰ ਫਿਰ ਇਸ ਕਰਕੇ ਆਪਾਂ ਜੋ ਕਿ ਸਾਡੇ ਸ਼ਹਿਰ ਕਰਕੇ ਜਾਣਾ ਪੈਂਦਾ ਹੈ ਇਸ ਕਰਕੇ ਆਪਾਂ ਉੱਥੇ ਜਾਣ ਵਾਸਤੇ ਲੇਟ ਹੋ ਜਾਂਦੇ ਹਨ ਅਤੇ ਇਸ ਕਰਕੇ ਸਾਨੂੰ ਸਾਡੇ ਸਰ ਕੋਲ ਬਹੁਤ ਹੀ ਮਤਲਬ ਕਿ ਝਿੜਕਾਂ ਵਗੈਰਾ ਵੀ ਪੈਂਦੀਆ ਹਨ ਇਸ ਕਰਕੇ ਸਾਡੀ ਆਵਾਜਾਈ ਨੂੰ ਵੱਧ ਤੋਂ ਵੱਧ ਇੱਥੇ ਵਧਾਉਣਾ ਚਾਹੀਦਾ ਹੈ ਅਤੇ ਬੱਸਾਂ ਦੇ ਤੌਰ ਤਰੀਕਿਆਂ ਨੂੰ ਵੀ ਸਮਝਣਾ ਚਾਹੀਦਾ ਹੈ ਕਿਉਂਕਿ ਬੱਸ ਵਾਲੇ ਇੱਕ ਸਵਾਰੀ ਸਵਾਰੀਆਂ ਕਰਕੇ ਬਹੁਤ ਸਾਰੀ ਬੱਸ ਨੂੰ ਆਪਣੀ ਭਰ ਲੈਂਦੇ ਹਨ ਜੋ ਕਿ ਇਹ ਇਸ ਕਰਕੇ ਸਾਨੂੰ ਵੀ ਬਹੁਤ ਸਾਰੀਆਂ ਝਾਂਜਨਾ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਕਰਕੇ ਲੋਕਾਂ ਦੀ ਨੇੜਲੇ ਸ਼ਹਿਰਾਂ ਵਿੱਚ ਵੀ ਅਤੇ ਕਸਬਿਆਂ ਵਿੱਚ ਵੀ ਬੱਸਾਂ ਦੀ ਆਵਾਜਾਈ ਨੂੰ ਸਹੀ ਤੌਰ 'ਤੇ ਕਰਨਾ ਚਾਹੀਦਾ ਹੈ ਕਿਉਂਕਿ ਜਿਸ ਕਰਕੇ ਬ ਲੋਕ ਆਪਣੇ ਆ ਆਵਾਜਾਈ ਦੇ ਆਦੀ ਕੋ ਪਰੇਸ਼ਾਨੀ ਨਾ ਹੋਣ ਅਤੇ ਉਹ ਵੀ ਆਪਣੇ ਕੰਮ ਤੋਰ 'ਤੇ ਸਹੀ ਤਰ੍ਹਾਂ ਜਾ ਸਕਣ ਕਿਉਂਕਿ ਸਾਡਾ ਇੱਥੇ ਪਿੰਡ ਹੈ ਇਸ ਕਰਕੇ ਇੱਥੇ ਬੱਸਾਂ ਬਹੁਤ ਹੀ ਘੱਟ ਆਉਂਦੀਆਂ ਹਨ ਜੇਕਰ ਆਉਂਦੀਆਂ ਵੀ ਹਨ ਤਾਂ ਕੋਈ ਬ ਕੋਈ ਭਰੀ ਹੋਈ ਆਉਂਦੀ ਹੈ ਇਸ ਕਰਕੇ ਆਪਾਂ ਹਰ ਸਾਲ ਲੇਟ ਹੋ ਜਾਂਦੇ ਹਨ ਅਤੇ ਇਸ ਕਰਕੇ ਸਾਨੂੰ ਰੋਜ਼ ਇਹ ਘਟਨਾਵਾਂ ਜਾਂਚਣਾ ਕਰਨਾ ਪੈਂਦਾ ਹੈ ਅਤੇ ਇਸ ਕਰਕੇ ਸਾਨੂੰ ਬੱਸਾਂ ਵਾਲਿਆਂ ਦੇ ਤੌਰ ਤਰੀਕਿਆਂ ਨੂੰ ਬਦਲਣਾ ਚਾਹੀਦਾ ਹੈ ਅਤੇ ਆਵਾਜਾਈ ਦੇ ਘੱਟ ਹੋਣ ਦੇ ਕਰਕੇ ਉਹਨਾਂ ਨੂੰ ਇਹਨਾਂ ਹੀ ਕ ਹੈ ਇਹ ਚੀਜ਼ ਦੀ ਮੰਗ ਕਰਨੀ ਚਾਹੀਦੀ ਹੈ ਕਿ ਕਿ ਬੱਸ ਵਾਲੇ ਆਪਣੇ ਬੱਸਾਂ ਨੂੰ ਉਸ ਹਿਸਾਬ ਨਾਲ ਹੀ ਭਰਨ ਜੋ ਕਿ ਲੋਕ ਜਿਹੜੇ ਆਉਂਦੇ ਜਾਂਦੇ ਤੰਗ ਵੀ ਨਾ ਹੋਣ ਅਤੇ ਉਹਨਾਂ ਦੀ ਨੌਕਰੀ ਵੀ ਕੋਈ ਪਰੇਸ਼ਾਨੀ ਨਾ ਆਵੇ ਇਸ ਕਰਕੇ ਸਾਡੇ ਸ਼ ਸਾਡੇ ਜੋ ਕਿ ਪਿੰਡ ਹੈ ਆਪਾਂ ਲੇਟ ਨਾ ਹੋ ਸਕੀਏ